ਪੰਜਾਬ ਵਿੱਚ ਸਿੱਖਿਆ ਖੇਤਰ ਵਿੱਚ ਕੰਮ ਕਰਨ ਦੇ ਬਹੁਤ ਸਾਰੇ ਮੌਕੇ ਹਨ ਮੈਂ ਵੀ ਕੱਚਾ ਅਧਿਆਪਕ ਤੌਰ 'ਤੇ ਕੰਮ ਕੀਤਾ ਇਸ ਵਿੱਚ ਮੈਨੂੰ ਬਹੁਤ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਮੈਂ ਕੰਮ ਲਗਾਤਾਰ ਕੰਮ ਕਰਦੀ ਰਹੀ ਅਤੇ ਮੇਰੇ ਕੰਮ ਦੇ ਅਨੁਸਾਰ ਮੈਨੂੰ ਬਹੁਤ ਹੀ ਘੱਟ ਪੇਮੈਂਟ ਮਿਲਦੀ ਸੀ ਜਿਸ ਕਰਕੇ ਮੈਨੂੰ ਕੰਮ ਮੈਂ ਕੰਮ ਕਰਦੀ ਰਹੀ ਪਰ ਮੈਨੂੰ ਮੇਰੀ ਮਿਹਨਤ ਦਾ ਕੋਈ ਵੀ ਸਹੀ ਹਿਸਾਬ ਨਹੀਂ ਮਿਲ ਸਕਿਆ ਇਸ ਕਰਕੇ ਮੈਨੂੰ ਬਹੁਤ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ